ਹਾਂਜੀ ਮੈਨੂੰ ਅੱਜ ਤੱਕ ਹਰ ਇੱਕ ਗਾਹਕ ਤੋਂ ਚੰਗੀ ਫੀਡਬੈਕ ਮਿਲੀ ਹੈ ਮੈਨੂੰ ਕਿਸੇ ਨੇ ਵੀ ਨੈਗੇਟਿਵ ਫੀਡ ਨਹੀਂ ਦਿੱਤੀ ਮੈਂ ਜਦ ਵੀ ਮਤਲਬ ਸਿਲਾਈ ਕੀਤੀ ਹੈ ਤਾਂ ਮੇਰੀ ਸਿਲਾਈ ਕੀਤੇ ਹੋਏ ਕੱਪੜੇ ਹਰ ਇੱਕ ਹਰ ਇੱਕ ਮਤਲਬ ਗਾਹਕ ਨੂੰ ਬਹੁਤ ਪਸੰਦ ਆਏ ਹਨ ਅਤੇ ਮੈਂ ਇੱਕ ਆਪਣੇ ਹੱਥੀਂ ਬਣਾ ਕੇ ਸੂਟ ਮਤਲਬ ਤਿਆਰ ਕਰਕੇ ਆਪਣੀ ਭੈਣ ਨੂੰ ਉਸਦੀ ਮੈਰਿਜ 'ਤੇ ਗਿਫਟ ਕੀਤਾ ਸੀ ਜੋ ਉਸਨੂੰ ਜਦ ਉਸਨੇ ਪਾਇਆ ਤਾਂ ਉਸਦੇ ਮਤਲਬ ਸਹੁਰੇ ਪਰਿਵਾਰ ਨੂੰ ਬਹੁਤ ਚੰਗਾ ਲੱਗਿਆ ਅਤੇ ਉਹਨਾਂ ਨੇ ਮੈਨੂੰ ਮਤਲਬ ਸਿਲਾਈ ਦਾ ਕੰਮ ਦਵਾਇਆ ਜਿਸ ਕਰਕੇ ਮੇਰਾ ਕੰਮ ਬਹੁਤ ਮਤਲਬ ਵਧੀਆ ਚੱਲਿਆ ਅਤੇ ਉਸ ਕਰਕੇ ਮੇਰੀ ਮਤਲਬ ਸਿਲਾਈ ਦੀ ਹੋਰ ਤਾਰੀਫ ਹੋਣ ਲੱਗੀ ਤਾਂ ਮੇਰਾ ਕੰਮ ਵਧੀਆ ਚੱਲਦਾ ਰਿਹਾ ਅਤੇ ਲੋਕ ਮੇਰੇ ਹੁਨਰ ਬਾਰੇ ਬਹੁਤ ਹੀ ਚੰਗਾ ਬੋਲਦੇ ਹਨ ਕਹਿੰਦੇ ਹਨ ਕਿ ਹੱਥੀਂ ਕੀਤੀ ਹੋਈ ਕਮਾਈ ਕਦੇ ਵੀ ਵਾਂਝੀ ਨਹੀਂ ਜਾਂਦੀ ਇਸ ਕਰਕੇ ਹੱਥੀਂ ਕਮਾਈ ਕਰਦੇ ਰਹੋ ਰੱਬ ਤੁਹਾਡੇ ਮਤਲਬ ਹਰ ਇੱਕ ਕੰਮ ਦੇ ਵਿੱਚ ਸਾਥ ਦੇਵੇਗਾ ਹੱਥੀਂ ਕੀਤੀ ਹੋਈ ਕਮਾਈ ਹਮੇਸ਼ਾਂ ਤਰੱਕੀ ਬਖਸ਼ਦੀ ਹੈ ਇਸ ਕਰਕੇ ਮੈਨੂੰ ਆਪਣੇ ਇਸ ਸਿਲਾਈ ਵਾਲੇ ਕੰਮ 'ਤੇ ਇਸ ਆਪਣੇ ਇਸ ਹੁਨਰ 'ਤੇ ਬਹੁਤ ਮਾਨ ਹੈ ਅਤੇ ਮੈਂ ਬਹੁਤ ਹੀ ਖੁਸ਼ ਹਾਂ ਕਿ ਮੈਨੂੰ ਇਸ ਇਸ ਹੁਨਰ ਵਾਸਤੇ ਰੱਬ ਨੇ ਮੈਨੂੰ ਚੁਣਿਆ ਕਿ ਮੇਰੇ ਹੱਥੀਂ ਕੀਤੇ ਹੋਏ ਕੱਪੜੇ ਤਿਆਰ ਕਰਕੇ ਗਾਹਕ ਮੇਰੇ ਬਹੁਤ ਖੁਸ਼ ਹਨ ਅਤੇ ਮੈਨੂੰ ਚੰਗੀ ਫੀਡਬੈਕ ਦਿੰਦੇ ਹਨ ਅਤੇ ਮੇਰੀ ਬਹੁਤ ਹੀ ਤਾਰੀਫ ਕਰਦੇ ਹਨ ਅਤੇ ਮੈਂ ਬਹੁਤ ਹੀ ਉਹਨਾਂ ਨੂੰ ਵੀ ਕਦੇ ਨਿਰਾਸ਼ ਨਹੀਂ ਕਰਦੀ ਅਤੇ ਮੈਂ ਬਹੁਤ ਹੀ ਖੁਸ਼ ਹਾਂ ਕਿ ਮੇਰੇ ਮਤਲਬ ਕਿ ਦਿੱਤੇ ਹੋਏ ਸਿਲਾਈ ਕੀਤੇ ਹੋਏ ਕੱਪੜੇ ਉਹਨਾਂ ਨੂੰ ਬਹੁਤ ਪਸੰਦ ਆਉਂਦੇ ਆਏ ਹਨ ਅਤੇ ਜਦ ਵੀ ਉਹ ਮੇਰੀ ਤਾਰੀਫ ਕਰਦੇ ਹਨ ਤਾਂ ਮੈਂ ਹਰ ਇੱਕ ਕੰਮ ਉਹਨਾਂ ਦਾ ਦਿਲੋਂ ਕਰਦੀ ਹਾਂ ਅਤੇ ਬਹੁਤ ਹੀ ਮਤਲਬ ਚਾਅ ਨਾਲ ਉਹਨਾਂ ਦੇ ਹਰ ਇੱਕ ਸੂਟ ਨੂੰ ਹਰ ਇੱਕ ਚੀਜ਼ ਨੂੰ ਚੰਗੇ ਮਨ ਲਾ ਕੇ ਹੱਥ ਨਾ ਹੱਥੀਂ ਕਿਰਤ ਕਰਕੇ ਦਿੰਦੀ ਹਾਂ ਜਿਸ ਕਰਕੇ ਉਹ ਵੀ ਖੁਸ਼ ਹੁੰਦੇ ਹਨ ਅਤੇ ਮੈਨੂੰ ਵੀ ਬਹੁਤ ਖੁਸ਼ੀ ਮਿਲਦੀ ਹੈ